ਮੇਰਾ ਨਾਮ ਰਜਨੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਟੂਰ ਏਜੰਸੀ ਵੱਲੋਂ ਮੇਰੇ ਲਈ ਟੂਰ 'ਤੇ ਜਾਣ ਦੇ ਲਈ ਜੋ ਕੈਬ ਬੁੱਕ ਕੀਤੀ ਗਈ ਸੀ ਉਸ ਦੇ ਦੱਸੇ ਅਨੁਸਾਰ ਮੈਂ ਚੰਡੀਗੜ੍ਹ ਏਅਰਪੋਰਟ ਦੇ ਨਜ਼ਦੀਕ ਉਡੀਕ ਕਰ ਰਹੀ ਹਾਂ ਲੇਕਿਨ ਹਜੇ ਤੱਕ ਉਹ ਕਾਰ ਮੇਰੇ ਤੱਕ ਨਹੀਂ ਪਹੁੰਚ ਸਕੀ ਸੋ ਮੈਂ ਆਪਣੀ ਇਸ ਯਾਤਰਾ ਨੂੰ ਕੈਂਸਲ ਕਰਨਾ ਚਾਹੁੰਦੀ ਹਾਂ ਕਿਉਂਕਿ ਮੈਂ ਡਰਾਈਵਰ ਦੇ ਨਾਲ ਬਹੁਤ ਦੇਰ ਦੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਡਰਾਈਵਰ ਮੇਰੇ ਦੱਸੇ ਹੋਏ ਸਥਾਨ ਅਤੇ ਨਿਰਧਾਰਿਤ ਜਗ੍ਹਾ 'ਤੇ ਪਹੁੰਚਣ ਦੇ ਵਿੱਚ ਅਸਫਲ ਹੋਇਆ ਹੈ ਅਤੇ ਮੈਂ ਬਹੁਤ ਦੇਰ ਤੋਂ ਏਜੰਸੀ ਦੇ ਨਾਲ ਕੋਂਟੈਕਟ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਮੈਂ ਇਸ ਦੇ ਵਿੱਚ ਅਸਫਲਤਾ ਨੂੰ ਦੇਖ ਰਹੀ ਹਾਂ ਇਸ ਕਾਰਨ ਮੈਂ ਆਪਣੇ ਇਸ ਟੂਰ ਨੂੰ ਅਤੇ ਆਪਣੀ ਇਸ ਯਾਤਰਾ ਨੂੰ ਕੈਂਸਲ ਕਰਵਾਉਣਾ ਚਾਹੁੰਦੀ ਹਾਂ ਕਿਰਪਾ ਕਰਕੇ ਮੇਰੀ ਮਜਬੂਰੀ ਨੂੰ ਸਮਝਿਆ ਜਾਵੇ ਅਤੇ ਡਰਾਈਵਰ ਦੇ ਨਾਲ ਗੱਲਬਾਤ ਕੀਤੀ ਜਾਵੇ ਕਿ ਉਹ ਮੈਨੂੰ ਇਸ ਨਿਰਧਾਰਿਤ ਸਥਾਨ ਤੋਂ ਪਿੱਕਅਪ ਕਰਨ ਦੇ ਵਿੱਚ ਮਦਦ ਕਰੇ ਤਾਂ ਕਿ ਮੈਂ ਸਮੇਂ ਸਿਰ ਆਪਣੇ ਉਸ ਸਥਾਨ 'ਤੇ ਪਹੁੰਚ ਸਕਾਂ ਜਿੱਥੇ ਕਿ ਏਜੰਸੀ ਵੱਲੋਂ ਟੂਰ ਜਾਣ ਦੇ ਲਈ ਤਿਆਰ ਹੋਇਆ ਸੀਗਾ ਮੈਂ ਡਰਾਈਵਰ ਦੇ ਲੇਟ ਆਉਣ ਅਤੇ